ਖੇਡਾਂ ਖੇਡਣ ਨਾਲ ਪੇਂਡੂ ਖੇਤਰ ਦੇ ਲੋਕਾਂ ਨੂੰ ਬਹੁਤ ਹੀ ਲਾਭ ਪਹੁੰਚਿਆ ਹੈ ਪਹਿਲਾਂ ਪਹਿਲਾਂ ਪਿੰਡਾਂ ਵਿੱਚ ਖੇਡਾਂ ਦੇ ਪ੍ਰਤੀ ਐਨਾ ਦਿਲਚਸਪੀ ਨਹੀਂ ਹੁੰਦੀ ਸੀ ਹੁਣ ਜਿਉਂ ਜਿਉਂ ਬੱਚਿਆਂ ਦੀ ਤੰਦਰੁਸਤੀ ਲਈ ਖੇਡਣਾ ਜ਼ਰੂਰੀ ਹੋ ਗਿਆ ਤਾਂ ਉਸ ਨਾਲ ਹਰੇਕ ਪਿੰਡ ਦੇ ਵਿੱਚ ਕਲੱਬ ਬਣਨ ਲੱਗ ਪਏ ਕਲੱਬਾਂ ਦੇ ਵਿੱਚ ਕੋਈ ਸਿਹਤਮੰਦ ਅੱਗੇ ਪੜ੍ਹਿਆ ਲਿਖਿਆ ਨੌਜਵਾਨ ਪੇਂਡੂ ਬੱਚਿਆਂ ਨੂੰ ਆਪਣੀ ਸਿਖਲਾਈ ਦੇ ਨਾਲ ਖੇਡਾਂ ਵੱਲ ਪ੍ਰੇਰਿਤ ਕਰ ਰਿਹਾ ਹੈ ਇਹ ਨਾਲ ਲਾਭ ਹੋਇਆ ਕਿ ਬੱਚੇ ਤੰਦਰੁਸਤ ਲੱਗ ਪਏ ਰਹਿਣ ਅਤੇ ਉਸ ਤੋਂ ਬਾਅਦ ਉਹਨਾਂ ਵਿੱਚ ਆਪਸੀ ਭਾਈਚਾਰਾ ਵੱਧ ਗਿਆ ਭਾਈਚਾਰਾ ਵਧਣ ਦੇ ਨਾਲ ਨਾਲ ਇਹ ਲੋਕ ਆਪਸ ਵਿੱਚ ਵੀ ਇੱਕ ਦੂਜੇ ਨਾਲ ਹਮਦਰਦੀ ਰੱਖਣ ਲੱਗ ਪਏ ਅਤੇ ਉਸ ਦੇ ਨਾਲ ਪਿੰਡਾਂ ਦੇ ਵਿੱਚ ਆਪਸੀ ਸਹਿਯੋਗ ਵੀ ਵਧਿਆ ਇਸ ਪ੍ਰਕਾਰ ਖੇਤਰ ਪੇਂਡੂ ਖੇਤਰ ਲੋਕਾਂ ਨੂੰ ਇਸ ਤੋਂ ਬਹੁਤ ਲਾਭ ਪਹੁੰਚਿਆ